ਜਿਵੇਂ ਕਿ ਮੇਰੀ ਰੁਚੀ ਡਰਾਇੰਗ ਦੇ ਵਿੱਚ ਹੈ ਨਾ ਕਿ ਚਿੱਤਰਕਾਰੀ ਕਰਨਾ ਅਤੇ ਮੈਂ ਕਾਫੀ ਇਸਦੇ ਵਿੱਚ ਜਿਵੇਂ ਯੂਟਿਊਬ ਹੋਇਆ ਜਾਂ ਫਿਰ ਹੋਰ ਮਾਧਿਅਮ ਹੈ ਉਹਨਾਂ ਦੇ ਵਿੱਚ ਚੈੱਕ ਕਰਦਾ ਰਹਿੰਦਾ ਵੀ ਕਿਤੇ ਕੋਈ ਕਲਾਕਾਰ ਦੀ ਕਿਹੜੀ ਵਧੀਆ ਹੈ ਯੂਟਿਊਬ 'ਤੇ ਕਾਫੀ ਵੀਡੀਓਜ਼ ਹੁੰਦੇ ਨੇ ਜਿਹਦੇ ਵਿੱਚ ਨਾ ਓਇਲ ਪੇਂਟਿੰਗ ਵਗੈਰਾ ਦੱਸੀ ਜਾਂਦੀ ਹੈ ਬਣਾ ਕੇ ਕਿ ਓਇਲ ਪੇਂਟਿੰਗ ਇਸ ਤਰ੍ਹਾਂ ਬਣਾਈ ਜਾਂਦੀ ਹੈ ਅਤੇ ਉਹਦੇ ਵਿੱਚ ਜਿਹੜੇ ਕਲਾਕਾਰ ਹੁੰਦੇ ਜਿਹੜੇ ਰਿਲਿਸਟਿਕ ਪੇਂਟਿੰਗ ਕਰਦੇ ਆ ਵੀ ਜਿਵੇਂ ਨਾ ਐਂ ਲੱਗਦਾ ਵੀ ਸਾਹਮਣੇ ਪਈ ਹੈ ਚੀਜ਼ ਉਸ ਤਰ੍ਹਾਂ ਦੀ ਚੀਜ਼ ਬਹੁਤ ਪਸੰਦ ਹੈ ਕਿ ਉਹ ਕਿਵੇਂ ਬਣਾਉਂਦੇ ਨੇ ਕਿ ਉਹਦੇ ਹਾਈਲਾਈਟ ਕਿਵੇਂ ਕਰਦੇ ਆ ਕਲਰ ਦਾ ਯੂਜ ਕਰਕੇ ਅਲੱਗ ਅਲੱਗ ਰੰਗਾਂ ਨੂੰ ਕਿਵੇਂ ਉਭਾਰਦੇ ਆ ਪਿੱਛੇ ਜਿਹੜੇ ਕੱਪੜੇ ਬਣੇ ਹੋਏ ਨੇ ਜਾਂ ਜੇ ਕਿਸੇ ਨੇ ਪਹਿਨੇ ਹੋਏ ਨੇ ਉਹਦੇ ਵਿੱਚ ਜਿਵੇਂ ਉਹਦੇ ਸਿਲਵਟਾਂ ਦਿੱਸਦੀਆਂ ਨੇ ਕਿ ਉਹਦੇ ਵੀ ਵੱਟ ਪਏ ਹੋਏ ਨੇ ਕਿਵੇਂ ਨੇ ਕਿ ਉਹ ਸਿੱਧਾ ਜਿਵੇਂ ਪ੍ਰੈੱਸ ਕੀਤਾ ਹੋਇਆ ਕਿ ਨਹੀਂ ਅਤੇ ਉਹ ਚੀਜ਼ਾਂ ਬਹੁਤ ਮੈਨੂੰ ਆਕਰਸ਼ਿਤ ਕਰਦੀਆਂ ਨੇ ਅਤੇ ਉਹ ਮੈਂ ਕਾਫੀ ਲੱਭ ਕੇ ਦੇਖਦਾ ਰਹਿੰਦਾ ਵੀਡੀਓਜ 'ਤੇ ਕਿਵੇਂ ਬਣਾਇਆ ਪਹਿਲਾਂ ਬੜਾ ਜਦੋਂ ਸਕੂਲ ਵੇਲੇ ਟਾਈਮ ਹੁੰਦਾ ਸੀ ਉਹ ਤਾਂ ਚਿੱਤਰਕਾਰੀ ਵਗੈਰਾ 'ਚ ਟਾਈਮ ਲੱਗ ਜਾਂਦਾ ਸੀ ਬਟ ਹੁਣ ਜੋਬ ਦੇ ਦੌਰਾਨ ਥੋੜ੍ਹਾ ਟਾਈਮ ਨਹੀਂ ਲੱਗਦਾ ਹੈਗਾ ਬਟ ਫਿਰ ਵੀ ਮੈਂ ਅੱਜ ਤੋਂ ਦੋ ਕੁ ਸਾਲ ਪਹਿਲਾਂ ਇੱਕ ਬਣਾਉਣ ਦੀ ਕੋਸ਼ਿਸ਼ ਕੀਤੀ ਸੀਗੀ ਉਹ ਕੰਪਲੀਟ ਵੀ ਕਰ ਲਈ ਸੀ ਬਟ ਹੁਣ ਲੱਗਦਾ ਵੀ ਕੋਈ ਸਹੀ ਨਹੀਂ ਬਣੀ ਹੈ ਬਟ ਮੈਂ ਫਿਰ ਵੀ ਹੁਣ ਟਾਈਮ ਲੱਭਦਾ ਰਿਹਾ ਵੀ ਕਿਤੇ ਟਾਈਮ ਮਿਲੇ ਅਤੇ ਉਹ ਕੰਮ ਕਰੀਏ ਅਤੇ ਹੋਰ ਜਿਵੇਂ ਪੁਰਾਣੇ ਜਿਹੜੇ ਸੀਗੇ ਆਪਣੇ ਕਲਾਕਾਰ ਜਿਵੇਂ ਲਿਨਾਰਡੋ ਦਾ ਵਿਨਚੀਓ ਉਹਦੀਆਂ ਪੇਂਟਿੰਗਸ ਮੈਂ ਕਾਫੀ ਦੇਖੀਆਂ ਨੇ ਫੋਲੋ ਕੀਤੀਆਂ ਨੇ ਅਤੇ ਰੁਚੀ ਆ ਅੱਛਾ ਲੱਗਦਾ ਚੰਗਾ ਕੰਮ ਦੇਖ ਕੇ ਕਿਸੇ ਦਾ